ਹੈਲੋ ਹਾਂਜੀ ਹਾਂਜੀ ਜੀ ਨਮਸਤੇ ਜੀ ਹਾਂਜੀ ਜੀ ਹਾਂਜੀ ਹਾਂਜੀ ਜੀ ਸਾਡੇ ਕੋਲ ਹੈਗੇ ਨਾ ਫੁੱਲ ਸਾਡੇ ਕੋਲ ਗੇਂਦਾ ਦਾ ਫੁੱਲ ਹੈ ਚਮੇਲੀ ਦਾ ਕਮਲ ਦਾ ਫੁੱਲ ਆ ਗੁਲਾਬ ਦੇ ਹੈ ਠੀਕ ਹੈ ਦੀ ਸਾਡੇ ਕੋਲ ਨਾ ਅਤੇ ਬੂਟੇ ਵੀ ਹੈਗੇ ਨਾ ਅਮਰੂਦ ਦਾ ਬੂਟਾ ਅੰਬ ਦਾ ਤਾਂ ਤੁਸੀਂ ਬੂਟਾ ਵੀ ਲੈ ਸਕਦੇ ਹੋ ਮਤਲਬ ਕਿ ਅਸੀਂ ਬੂਟਿਆਂ ਦਾ ਵੀ ਵਪਾਰ ਖੋਲ੍ਹਿਆ ਵਿਆ ਤਾਂ ਅਸੀਂ ਰੇਟ ਬਿਲਕੁਲ ਜਾਇਜ ਲਾਵਾਂਗੇ ਮਤਲਬ ਕਿ ਘੱਟ ਤੋਂ ਘੱਟ ਲਾਵਾਂਗੇ ਰੇਟ ਠੀਕ ਆ ਦੀਦੀ ਰੇਟ ਮੈਂ ਤੁਹਾਨੂੰ ਘੱਟ ਤੋਂ ਘੱਟ ਲਾਵਾਂਗੀ ਠੀਕ ਹੈ ਹਾਂਜੀ ਫੁੱਲ ਵੀ ਤਾਜ਼ੇ ਹੋਣਗੇ ਇਕਦਮ ਠੀਕ ਹੈ ਠੀਕ ਹੈ ਜੀ